ਭਾਸ਼ਾ ਵਿੱਚ ਦਿਲਚਸਪ ਅਤੇ ਅਸਧਾਰਨ ਸ਼ਬਦ ਜਾਂ ਸਾਨੂੰ ਕੁਛ ਵੀ ਕਹਿ ਸਕਦੇ ਹਾਂ ਕਿ ਕਾਫੀ ਧਿਆਨ ਦੇ ਕੇ ਅਸੀਂ ਸੋਚਦੇ ਹਾਂ ਕਿ ਇਹ ਇਹਨਾਂ ਦਾ ਜਿਹੜੀ ਪੰਜਾਬੀ ਭਾਸ਼ਾ ਹੈਗੀ ਹੈ ਕਾਫੀ ਰਿੱਚ ਹੈ ਕਲਚਰ ਇਹਦਾ ਅਤੇ ਜੋ ਵੀ ਅਸੀਂ ਇ ਇਹਦਾ ਬਾਰੇ ਕੁੜੀ ਦੇ ਵਿਆਹ ਵਾਲੇ ਘੋੜੀਆਂ ਸੁਹਾਗੇ ਜੋ ਵੀ ਬੋਲੀਆਂ ਪਾਂਨੇ ਹਾਂ ਇਹ ਇੱਕ ਸ਼ਾਦੀ ਦੇ ਵਿੱਚ ਚਾਰ ਚਾਂਦ ਲਗਾ ਦਿੰਦੀ ਆ ਬੜਾ ਰੌਣਕ ਲੱਗ ਜਾਂਦੀ ਹੈ ਇੱਕ ਸਾਡੇ ਪੰਜਾਬੀ ਗਾਣੇ ਆ ਜਿਹੜੇ ਉਹ ਕਿਸੇ ਵੀ ਵਿਆਹ ਵਿੱਚ ਜੇ ਉਹਦੇ ਬਗੈਰ ਤਾਂ ਵਿਆਹ ਸੱਜਦਾ ਹੀ ਨਹੀਂ ਅਤੇ ਉਹ ਬੋਲਣਾ ਤਾਂ ਹਮੇਸ਼ਾਂ ਹੀ ਹੁੰਦਾ ਵੈ ਅਤੇ ਗਿੱਧਾ ਸਾਡਾ ਵੈਸੇ ਹੀ ਬੜਾ ਪਾਪੂਲਰ ਹੈ ਔਰ ਭੰਗੜਾ ਸਾਡੇ ਦੇਸ਼ ਦਾ ਉਹ ਉਹਦੀਆਂ ਉਹ ਵੀ ਜਿਹੜੇ ਟੱਪੇ ਆ ਉਹ ਵੀ ਬੜੇ ਸਾਡੇ ਪਾਪੂਲਰ ਹੈਗੇ ਆ ਸਾਡੇ ਪੰਜਾਬੀ ਭਾਸ਼ਾ 'ਚ ਉਂਝ ਸਾਰੇ ਹੀ ਇੱਕ ਤੋਂ ਇੱਕ ਵੱਧ ਇੰਡਸਟਰੀ ਹੈਗੀ ਹੈ ਜਿਹੜੀਆਂ ਕਿ ਹਾਲੇ ਵੀ ਚੱਲੀਆਂ ਆ ਰਹੀ ਹੈ ਅਤੇ ਕਈ ਹਾਲੇ ਵੀ ਜਿਹੜੇ ਹੈਗੇ ਆ ਵਿਆਹ ਵਾਲੇ ਜਿਹੜੇ ਗਾਣੇ ਬੋਲਦੇ ਐਂ ਅਸੀਂ ਉਹ ਹਾਲੇ ਵੀ ਬੋਲੇ ਜਾਂਦੇ ਉਹ ਕਈ ਗਾਣੇ ਇੰਨੇ ਰੌਵਾਨ ਵਾਲੇ ਹੈਗੇ ਆ ਕਿ ਤੁਸੀਂ ਬਧੋ ਬਧੀ ਪੜ੍ਹ ਸੁਣ ਕੇ ਰੋ ਪਵੋਗੇ ਉਹ ਅਤੇ ਕਈ ਇਹਨਾਂ ਦੇ ਜਿਹੜੇ ਹੈਗੀ ਹੈ ਕਲਚਰ ਜਿਹੜਾ ਹੈਗਾ ਏ ਰਿੱਚ ਉਹ ਤਾਂ ਸਦਾ ਹੀ ਰਹਿਣਾ ਵਾ ਅਤੇ ਸਾਨੂੰ ਇਹਨਾਂ ਦੇ ਪੰਜਾਬੀ ਗਾਣੇ ਬੋਲੀਆਂ ਗਿੱਧਾ ਟੱਪੇ ਹੋਰ ਭੰਗੜੇ ਦੇ ਜੋ ਵੀ ਗੀਤ ਹੈਗੇ ਆ ਉਹਦੇ ਬਗੈਰ ਕੋਈ ਵੀ ਵਿਆਹ ਸ਼ਾਦੀ ਨਹੀਂ ਸੱਜਦਾ ਅਤੇ ਸਾਡਾ ਪੰਜਾਬੀ ਜਿਹੜਾ ਹੈਗਾ ਵੈ ਹਮੇਸ਼ਾਂ ਹੀ ਇੱਕ ਐਨਰਜੈਟਿਕ ਲੈਵਲ 'ਤੇ ਰਹਿੰਦਾ ਵੈ